ਮੈਂ ਅੱਜ ਅੰਮ੍ਰਿਤਸਰ ਜਾਣ ਵਾਸਤੇ ਓਲਾ ਕੈਬ ਬੁੱਕ ਕੀਤੀ ਬਟ ਉਹ ਓਲਾ ਕੈਬ ਟਾਈਮ ਸਿਰ ਨਹੀਂ ਆਈ ਜਿਹਦੇ ਕਿ ਕਰਕੇ ਮੈਨੂੰ ਮੈਨੂੰ ਰੱਦ ਕਰਨਾ ਪੈ ਰਿਹਾ ਕਿਉਂਕਿ ਮੇਰੀ ਉੱਥੇ ਜੋਬ ਅਪੋਆਇੰਟਮੈਂਟ ਹੈ ਅਤੇ ਔਲਰੇਡੀ ਮੈਨੂੰ ਅੱਧਾ ਘੰਟਾ ਮੈਂ ਲੇਟ ਹੋ ਚੁੱਕੀ ਹਾਂ ਇਸ ਕਰਕੇ ਮੈਂ ਆਪਣਾ ਓਲਾ ਕੈਬ ਰੱਦ ਕਰਦੀ ਹਾਂ